ਭੰਗੜੇ ਦੇ ਕੁਛ ਆਮ ਸਟੈਪ ਹਨ ਜਿਵੇਂ ਕਿ ਮੱਲ ਸਿੰਗਲ ਜੱਫਾ ਡਬਲ ਜੱਫਾ ਝੂੰਮਰ ਧਮਾਲ ਲੁੱਡੀ ਵਗੈਰਾ ਅਤੇ ਇਹ ਸਟੈਪ ਭੰਗੜੇ ਦੇ ਡਾਂਸ ਵਿੱਚ ਹੋਰ ਵੀ ਜ਼ਿਆਦਾ ਜੋਸ਼ ਅਤੇ ਜਜ਼ਬਾ ਭਰ ਦਿੰਦੇ ਹਨ